ਮੇਰੇ ਮਨ ਪਸੰਦ ਲੇਖਕ ਹਨ ਮੇਰੇ ਮਾਮਾ ਜੀ ਉਹ ਪਹਿਲਾਂ ਤਾਂ ਡਿਪਟੀ ਕਮਿਸ਼ਨਰ ਸਨ ਅਤੇ ਜਦੋਂ ਉਹ ਰਿਟਾਇਰ ਹੋਏ ਤਾਂ ਉਹਨਾਂ ਨੇ ਨਾਵਲ ਲਿਖਣੇ ਸ਼ੁਰੂ ਕ ਕਰ ਦਿੱਤੇ ਦੇਖੋ ਇਹ ਜੋ ਲਿਖਣ ਲਿਖਾਣ ਦਾ ਸ਼ੌਂਕ ਇਹ ਇੱਕ ਦਿਨ ਦੇ ਵਿੱਚ ਤਾਂ ਪੈਦਾ ਨਹੀਂ ਹੁੰਦਾ ਉਹਨਾਂ ਨੂੰ ਸ਼ੁਰੂ ਤੋਂ ਹੀ ਜਦੋਂ ਉਹ ਐੱਮ ਏ ਕਰ ਰਹੇ ਸੀਗੇ ਉਦੋਂ ਤੋਂ ਹੀ ਉਹਨਾਂ ਨੂੰ ਪੜ੍ਹਾਈ ਅਤੇ ਲਿਖਾਈ ਦਾ ਬਹੁਤ ਹੀ ਸ਼ੌਂਕ ਸੀਗਾ ਉਹ ਆਪਣੀ ਨੌਕਰੀ ਦੇ ਦੌਰਾਨ ਕਿਉਂਕਿ ਬਹੁਤ ਹੀ ਵਿਅਸਤ ਹੋ ਗਏ ਇਸ ਲਈ ਉਸ ਟਾਈਮ 'ਤੇ ਉਹ ਨਾਵਲ ਆਦਿ ਨਹੀਂ ਲਿਖ ਸਕੇ ਤਾਂ ਜਦੋਂ ਹੀ ਉਹ ਰਿਟਾਇਰ ਹੋਏ ਉਹਨਾਂ ਨੇ ਇਸ ਕੰਮ ਦੇ ਵਿੱਚ ਆਪਣਾ ਮੋਰਚਾ ਸੰਭਾਲ ਲਿਆ ਸਭ ਤੋਂ ਪਹਿਲਾਂ ਉਹਨਾਂ ਨੇ ਨਾਵਲ ਲਿਖਿਆ ਕੌਣ ਦਿਲਾਂ ਦੀਆਂ ਜਾਣੇ ਤਾਂ ਜੋ ਉਹ ਚੀਜ਼ਾਂ ਲਿਖਦੇ ਹਨ ਉਹ ਬੜੀਆਂ ਹੀ ਪ੍ਰਾਕ੍ਰਿਤਿਕ ਹੁੰਦੀਆਂ ਹਨ ਪੜ੍ਹ ਕੇ ਤੁਹਾਨੂੰ ਲੱਗਦਾ ਹੀ ਨਹੀਂ ਕਿ ਤੁਸੀਂ ਕੁਛ ਓਪਰਾ ਪੜ੍ਹ ਰਹੇ ਹੋ ਜਾਂ ਕਿਸੇ ਦੀ ਹੋਰ ਚੀਜ਼ ਪੜ੍ਹ ਰਹੇ ਹੋ ਇਹ ਲੱਗਦਾ ਕਿ ਸਾਰਾ ਕੁਛ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੀ ਹੋ ਰਿਹਾ ਹੈ ਜਿਸ ਤਰ੍ਹਾਂ ਕਿ ਉਹਨਾਂ ਨੇ ਜੋ ਨਾਵਲ ਲਿਖਿਆ ਲੋ ਕੋਣ ਦਿਲਾਂ ਦੀਆਂ ਜਾਣੇ ਲੋਕਾਂ ਨੇ ਉਸ ਨਾਵਲ ਨੂੰ ਬਹੁਤ ਪਸੰਦ ਕੀਤਾ ਬਹੁਤ ਵਧੀਆ ਵਧੀਆ ਦੂਰੋਂ ਦੂਰੋਂ ਤੱਕ ਉਸ ਨਾਵਲ ਦੇ ਰਿਵਿਊ ਆਏ ਅਤੇ ਉੱਦੋਂ ਬਾਅਦ ਉਹਨਾਂ ਨੇ ਦੂਸਰਾ ਨਾਵਲ ਲਿਖਿਆ ਮੱਸਿਆ ਮੇਂ ਖਿਲਿਆ ਚਾਂਦ ਉਹ ਨਾਵਲ ਵੀ ਲੋਕਾਂ ਨੇ ਬਹੁਤ ਪਸੰਦ ਕੀਤਾ ਅਤੇ ਉਹ ਜੋ ਉਹ ਨਾਵਲ ਲਿਖਦੇ ਹਨ ਕਿਉਂਕਿ ਉਹ ਖੁਦ ਵੀ ਇੱਕ ਪ੍ਰਸ਼ਾਸਨਿਕ ਅਧਿਕਾਰੀ ਰਹਿ ਚੁੱਕੇ ਹਨ ਤਾਂ ਜਿਹੜਾ ਦੂਸਰਾ ਨਾਵਲ ਉਹਨਾਂ ਦਾ ਸੀਗਾ ਉਹ ਬਿਲਕੁਲ ਹੀ ਜਿਹੜੇ ਬੱਚੇ ਸਰਕਾਰੀ ਨੌਕਰੀਆਂ ਬਾਰੇ ਤਿਆਰੀ ਕਰਦੇ ਹਨ ਉਹਨਾਂ ਲਈ ਬਹੁਤ ਹੀ ਲਾਹੇਵੰਦ ਹੈ ਕਿਉਂਕਿ ਉਹਦੇ ਵਿੱਚ ਉਹਨਾਂ ਨੇ ਆਪਣੇ ਸਾਰੇ ਤਜਰਬੇ ਲਿਖੇ ਜੋ ਦਿੱਲੀ ਗਏ ਸੀਗੇ ਉੱਥੇ ਉਹਨਾਂ ਨੇ ਕੋਚਿੰਗ ਲਿੱਤੀ ਸੀਗੀ ਉੱਥੇ ਕਿਵੇਂ ਹੁੰਦਾ ਕੋਚਿੰਗ ਵਾਲੇ ਕਿਵੇਂ ਪੜ੍ਹਾਉਂਦੇ ਹਨ ਅਤੇ ਉੱਥੋਂ ਆ ਕੇ ਤੁਸੀਂ ਆਪਦੇ ਸ਼ਹਿਰ ਦੇ ਵਿੱਚ ਆਪਦੇ ਦੋਸਤ ਨੂੰ ਕਿਵੇਂ ਤੁਸੀਂ ਇਹਦੇ ਬਾਰੇ ਗਾਈਡ ਕਰ ਸਕਦੇ ਹੋ ਤੁਸੀਂ ਮਿਲ ਕੇ ਗਰੁੱਪ ਵਿੱਚ ਕਿਵੇਂ ਪੜ੍ਹ ਸਕਦੇ ਹਾਂ ਪੜ੍ਹ ਸਕਦੇ ਹੋ ਅਤੇ ਉਹ ਨਾਵਲ ਪੜ੍ਹ ਕੇ ਬੜਾ ਹੀ ਮਜ਼ਾ ਆਉਂਦਾ ਹੁਣ ਤਾਂ ਉਹਨਾਂ ਨੇ ਇੱਕ ਦੋ ਨਹੀਂ ਤਿੰਨ ਚਾਰ ਨਾਵਲ ਹੋਰ ਲਿਖੇ ਹੈ ਅਤੇ ਹੁਣ ਤਾਂ ਜਿਹੜੇ ਉੱਚੇ ਕੋਟੀ ਦੇ ਲੇਖਕ ਹਨ ਉਹਨਾਂ ਦੇ ਵਿੱਚ ਵੀ ਉਹਨਾਂ ਦਾ ਨਾਮ ਆਉਣਾ ਸ਼ੁਰੂ ਹੋ ਗਿਆ ਹੈ ਤਾਂ ਮੈਂ ਆਪਣੇ ਮਾਮਾ ਜੀ ਦੇ ਨਾਵਲਾਂ ਨੂੰ ਬਹੁਤ ਪਸੰਦ ਕਰਦੀ ਹਾਂ ਅਤੇ ਉਹਨਾਂ ਨੇ ਨਾਵਲਾਂ ਦੇ ਵਿੱਚ ਮੇਨ ਚੀਜ਼ ਇਹ ਹੀ ਹੈ ਕਿ ਉਹ ਬੜਾ ਪ੍ਰਾਕ੍ਰਿਤਿਕ ਤਰੀਕੇ ਨਾਲ ਲਿਖਦੇ ਹਨ ਬੜਾ ਹੀ ਨੋਰਮਲ ਜਿਹਾ ਹੁੰਦਾ ਤੁਹਾਨੂੰ ਇਹ ਲੱਗਦਾ ਕਿ ਵਾਕੇ ਹੀ ਇਹ ਚੀਜ਼ਾਂ ਬਿਲਕੁਲ ਸਹੀ ਇਹ ਹੋਈਆਂ ਨੇ ਚੀਜ਼ਾਂ ਇਸ ਤਰ੍ਹਾਂ ਕਰਕੇ ਕੁਛ ਵੀ ਆ ਕੁਛ ਵੀ ਬਨਾਵਟੀ ਨਹੀਂ ਲੱਗਦਾ